ਰੂਪਨਗਰ ਦੇ ਵਿੱਚ ਬਹੁਤ ਸਾਰੇ ਮਹੱਤਵਪੂਰਨ ਸਥਾਨ ਹੈ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਟਿੱਬੀ ਸਾਹਿਬ ਹੈ ਅਤੇ ਇੱਥੇ ਦਾ ਇੱਕ ਹੈੱਡ ਹੈ ਜਿੱਥੇ ਪਾਣੀ ਦਾ ਪੁੱਲ ਮਤਲਬ ਪਾਣੀ ਨੂੰ ਰੋਕਿਆ ਗਿਆ ਹੈ ਅਤੇ ਉੱਥੇ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਹੈ ਅਤੇ ਅਸੀਂ ਉੱਥੇ ਜਾ ਸਕਦੇ ਆ ਉੱਥੇ ਪਹੁੰਚਣ ਵਾਸਤੇ ਸਾਨੂੰ ਕਿਸੀ ਵੀ ਟਾਇਪ ਦੀ ਕੋਈ ਰੋਕ ਨਹੀਂ ਹੈਗੀ ਅਸੀਂ ਇਜ਼ੀਲੀ ਉੱਥੇ ਜਾ ਸਕਦੇ ਹਾਂ ਜਾ ਕੇ ਆਪਣਾ ਘੁੰਮ ਸਕਦੇ ਹਾਂ ਅਤੇ ਬੱਚਿਆ ਨੂੰ ਘੁੰਮਾ ਸਕਦੇ ਹਾਂ ਅਤੇ ਮਿਉਂਜੀਅਮ ਵੀ ਬਣਿਆ ਹੋਇਆ ਜਿਸ ਰਾਹੀਂ ਸਾਨੂੰ ਆਪਣੇ ਇਤਿਹਾਸ ਬਾਰੇ ਵੀ ਪਤਾ ਲੱਗਦਾ ਹੈ